ਪੰਜਾਬ ਵਿੱਚ ਬਹੁਤ ਹੀ ਵਿਕਾਸ ਹੋਏ ਹਨ ਅਤੇ ਇੱਥੇ ਕਈ ਸਾਰੀਆਂ ਵਰਕਸ਼ੋਪਾਂ ਲੱਗੀਆਂ ਹਨ ਜਿਹਦੇ ਨਾਲ ਸਾਡਾ ਆਪਣਾ ਸਟਾਰਟਅੱਪ ਅਸੀਂ ਖੋਲ੍ਹ ਸਕਦੇ ਹਾਂ ਇਸ ਵਿੱਚ ਸ ਕਈ ਕਾਲਜ ਜਿਵੇਂ ਕਿ ਜੀ ਐਨੀ ਯੂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਦੇ ਵਿਦਿਆਰਥੀ ਮਕੈਨਿਕਲ ਇੰਜੀਨੀਅਰਿੰਗ ਦੇ ਸਟੂਡੈਂਟਸ ਵੀ ਕਈ ਵਰਕਸ਼ੋਪਾਂ ਲਾਉਂਦੇ ਹਨ ਜਿਸ ਵਿੱਚ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਫੌਰਜਿੰਗ ਕਾਸਟਿੰਗ ਅਤੇ ਵੈਲਡਿੰਗ ਕਿਵੇਂ ਕੀਤੀ ਜਾਂਦੀ ਹੈ ਕੁਛ ਕ ਇੰਡਸਟਰੀ ਵੀ ਹਨ ਇੱਥੇ ਸਾਈਕਲਸ ਦੀ ਅਤੇ ਮੋਟਰ ਪਾਰਟਸ ਦੀ ਜੋ ਕਿ ਅੱਗੇ ਐਕਸਪੋਰਟ ਵੀ ਕੀਤੀ ਜਾਂਦੀ ਹਨ ਅਤੇ ਪੰਜਾਬ ਵਿੱਚ ਕਈ ਕਈ ਇਹੋ ਜਿਹੇ ਮਹਾਨ ਸਟਾਰਟਅਪ ਖੁੱਲ੍ਹੇ ਹਨ ਜੋ ਕਿ ਆਉਣ ਵਾਲੀ ਤਰੱਕੀ ਵੀ ਪ੍ਰਾਪਤ ਕਰ ਰਹੇ ਹਨ ਅਤੇ ਸਟਾਰਟਅਪਸ ਆਮ ਆਦਮੀ ਲਈ ਬਹੁਤ ਹੀ ਸੌਖੇ ਹੋ ਗਏ ਹਨ ਤਾਂ ਕਿ ਉਹ ਛੋਟੇ ਸਕੇਲ ਦੀ ਇੰਡਸਟਰੀ ਵੀ ਅੱਗੇ ਵੱਧ ਸਕੇ ਅਤੇ ਕਈ ਪੜ੍ਹਦੇ ਵਿਦਿਆਰਥੀ ਕਾਲਜ ਦੇ ਵਿੱਚ ਕਾਲਜ ਵਿੱਚ ਵੀ ਸਿੱਖਦੇ ਹਨ ਕਿ ਕਿਵੇਂ ਇੱਕ ਸਮਾਲ ਸਕੇਲ ਇੰਡਸਟਰੀ ਲਾਸਟ ਸਕੇਲ 'ਚ ਉਪ ਬਦਲ ਸਕਦੀ ਹੈ ਚਾਹੇ ਉਹ ਜਿਹੋ ਜਿਹੀ ਮਰਜ਼ੀ ਟੈ ਚਾਹੇ ਉਹ ਕਿਸੇ ਵੀ ਪ੍ਰਕਾਰ ਦੀ ਇੰਡਸਟਰੀ ਕਿਉਂ ਨਾ ਹੋਵੇ ਉਸ ਉਸ ਵਿੱਚ ਵਿਕਾਸ ਵੀ ਹੋ ਸਕ ਹੋ ਸਕਦੇ ਹਨ ਤਾਂ ਕਿ ਉਹ ਅੱ ਅੱਗੇ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਸਕੇ ਕਈ ਸਰਕਾਰ ਦੀਆਂ ਦਿੱਤੀਆਂ ਸਬਸਿਡੀਆਂ ਵੀ ਹਨ ਜਿਸ ਨਾਲ ਇੱਕ ਆਮ ਆਦਮੀ ਕੋਈ ਵੀ ਸਟਾਰਟਅਪ ਖੋਲ੍ਹ ਸਕਦਾ ਹੈ